ਹਾਂ ਮੈਂ ਬਹੁਤ ਸਾਰੇ ਡਾਂਸ ਮੁਕਾਬਲਿਆਂ 'ਚ ਹਿੱਸਾ ਲਿਆ ਹੋਇਆ ਸਪੈਸ਼ਲੀ ਸਕੂਲ ਟਾਈਮ 'ਤੇ ਤਾਂ ਬਹੁਤ ਸਾਰੇ ਡਾਂਸ ਮੁਕਾਬਲਿਆਂ 'ਚ ਹਿੱਸਾ ਲਿਆ ਹੋਇਆ ਜਦੋਂ ਮੈਂ ਸਕੂਲ 'ਚ ਸੀਗੀ ਤਾਂ ਸਕੂਲ 'ਚ ਜਿੱਦਾਂ ਨਿੱਤ ਆਏ ਦਿਨ ਕੋਈ ਨਾ ਕੋਈ ਫੰਕਸ਼ਨ ਹੁੰਦਾ ਸੀਗਾ ਕਦੀ ਮਦਰਸ ਡੇਅ ਦਾ ਕਦੀ ਐਨੂਅਲ ਫੰਕਸ਼ਨ 'ਤੇ ਕਦੀ ਟੀਚਰਸ ਡੇਅ ਕਦੀ ਕੁਛ ਕਦੀ ਕੁਛ ਇਹਨਾਂ 'ਚੋਂ ਤਾਂ ਬਹੁਤ ਹਿੱਸਾ ਲਿਆ ਹੋਇਆ ਬਹੁਤ ਸਾਰੇ ਇਹਨਾਂ 'ਚ ਸਕੂਲ ਟਾਈਮ 'ਤੇ ਡਾਂਸ ਜਿਹੜੇ ਕੋਂਪੀਟੀਸ਼ਨ ਹੁੰਦੇ ਸੀਗੇ ਕਲਾਸ ਵਾਈਜ ਸਕੂਲ ਵਾਈਜ ਬਹੁਤ ਸਾਰੇ ਡਾਂਸ ਕੋਂਪੀਟੀਸ਼ਨ 'ਚ ਹਿੱਸਾ ਲਿਆ ਹੋਇਆ ਅਤੇ ਮੇਰਾ ਡਾਂਸ ਫੋਰਮ ਜਿਹੜਾ ਸੀਗਾ ਉਹ ਮੈਂ ਜ਼ਿਆਦਾਤਰ ਗਿੱਧਾ ਬੋਲੀਵੁੱਡ ਅਤੇ ਭੰਗੜਾ ਮੈਨੂੰ ਬਹੁਤ ਪਸੰਦ ਸੀ ਉਹ ਭੰਗੜਾ ਬਹੁਤ ਕਰਦੀ ਸੀਗੀ ਅਤੇ ਭੰਗੜਾ ਤਾਂ ਮੈਂ ਆਪਣੇ ਸਟੇਟ ਲੈਵਲ 'ਤੇ ਵੀ ਪਾਰਟੀਸਪੇਟ ਕੀਤਾ ਹੋਇਆ ਜਦੋਂ ਮੈਂ ਕੋਲਜ 'ਚ ਸੀਗੀ ਤਾਂ ਸਾਡੇ ਇੰਟਰ ਕੋਲਜ ਕੋਂਪੀਟੀਸ਼ਨ ਹੋਇਆ ਸੀਗਾ ਉਹਦੇ 'ਚ ਮੈਂ ਸੋਲੋ ਡਾਂਸ ਪਰਫੋਰਮ ਕੀਤਾ ਸੀਗਾ ਭੰਗੜੇ ਦਾ ਅਤੇ ਉਹਦੇ 'ਚ ਮੈਂ ਸੈਕਿੰਡ ਪ੍ਰਾਈਜ਼ ਵਿਨ ਕੀਤਾ ਸੀਗਾ ਅਤੇ ਉਸ ਤੋਂ ਇਲਾਵਾ ਵੀ ਬਹੁਤ ਸਾਰੇ ਡਾਂਸ ਕੋਂਪੀਟੀਸ਼ਨਸ 'ਚ ਪਾਰਟ ਲਿਆ ਹੋਇਆ ਇਹ ਨਹੀਂ ਕਿ ਬਹੁਤ ਜ਼ਿਆਦਾ ਹਾਈ ਲੈਵਲ 'ਤੇ ਅ ਕੋਈ ਡਾਂਸ ਕੋਂਪੀਟੀਸ਼ਨ 'ਚ ਪਾਰਟ ਲਿਆ ਕਿਉਂਕਿ ਇੰਨਾ ਜ਼ਿਆਦਾ ਸਾਡੇ ਵੱਲ ਇੰਨਾ ਜ਼ਿਆਦਾ ਮੰਨਦੇ ਨਹੀਂ ਹੈਗੇ ਇਹ ਚੀਜ਼ਾਂ ਨੂੰ ਬਟ ਹਾਂ ਸਕੂਲ ਕੋਲਜ ਟਾਈਮ 'ਤੇ ਜਿਹੜੀ ਕਾਲਜ ਇੰਟਰ ਕਾਲਜ ਕੋਂਪੀਟੀਸ਼ਨ ਹੁੰਦੇ ਸੀਗੇ ਇੰਟਰ ਸਕੂਲ ਕੋਂਪੀਟੀਸ਼ਨ ਹੁੰਦੇ ਸੀਗੇ ਉਹਨਾਂ 'ਚ ਬਹੁਤ ਸਾਰੇ ਕੋਂਪੀਟੀਸ਼ਨਸ 'ਚ ਪਾਰਟ ਲਿਆ ਹੋਇਆ ਕੁਛ 'ਚ ਬਾਲੀਵੁੱਡ ਕੀਤਾ ਹੋਇਆ ਕੁਛ 'ਚ ਭੰਗੜਾ ਕੀਤਾ ਹੋਇਆ ਮੈਨੂੰ ਸਪੈਸ਼ਲੀ ਭੰਗੜਾ ਬਹੁਤ ਪਸੰਦ ਸੀਗਾ ਅਤੇ ਭੰਗੜੇ 'ਚ ਤਾਂ ਬਹੁਤ ਸਾਰੇ ਡਾਂਸ ਕੋਂਪੀਟੀਸ਼ਨ 'ਚ ਪਾਰਟ ਲਿਆ ਹੋਇਆ ਈਵਨ ਜਦੋਂ ਸਾਡੇ ਅ ਕੋਲਜ ਦੀ ਫੈਅਰਵਲ ਪਾਰਟੀ ਸੀਗੀ ਸਾਨੂੰ ਫੈਅਰਵਲ ਮਿਲਣੀ ਸੀਗੀ ਮੇਰਾ ਲਾਸਟ ਈਅਰ ਸੀਗਾ ਕੋਲਜ ਦਾ ਉਦੋਂ ਵੀ ਮੈਂ ਭੰਗੜੇ ਦੀ ਪਰਫੋਰਮੈਂਸ ਦਿੱਤੀ ਸੀਗੀ ਤਾਂ ਮੈਨੂੰ ਯਾਦ ਹੈ ਸਾਰਿਆਂ ਨੇ ਮੇਰੀ ਭੰਗੜੇ ਦੀ ਪਰਫੋਰਮੈਂਸ ਬਹੁਤ ਪਸੰਦ ਕੀਤੀ ਸੀ ਅਤੇ ਉਹਦਾ ਵੀ ਮੈਨੂੰ ਮਤਲਬ ਇੱਕ ਸਪੈਸ਼ਲ ਪ੍ਰਾਈਜ ਮੇਰੇ ਕੋਲਜ ਵਾਲਿਆਂ ਨੇ ਦਿੱਤਾ ਸੀਗਾ ਬੈਸਟ ਪਰਫੋਰਮੈਂਸ ਦਾ ਤਾਂ ਮੈਨੂੰ ਬਹੁਤ ਵਧੀਆ ਲੱਗਾ ਸੀਗਾ ਬਸ ਭੰਗੜੇ ਦਾ ਤਾਂ ਇੰਨਾ ਕਰੀ ਆ ਡਾਂਸ ਦਾ ਤਾਂ ਇੰਨਾ ਕਰੀ ਹੈ ਅਤੇ ਇੰਨਾ ਕਰੀ ਮਤਲਬ ਪਾਰਟ ਲਿਆ ਹੋਇਆ ਬਹੁਤ ਜ਼ਿਆਦਾ ਇੰਟਰਨੈਸ਼ਨਲ ਜਾਂ ਫਿਰ ਨੈਸ਼ਨਲ ਲੈਵਲ 'ਤੇ ਤਾਂ ਨਹੀਂ ਕੀਤਾ ਹੋਇਆ ਬਟ ਹਾਂ ਸਕੂਲ ਇੰਟਰ ਕੋਲਜ ਕੋਂਪੀਟੀਸ਼ਨਸ 'ਚ ਬਹੁਤ ਪਾਰਟ ਲਿਆ ਹੋਇਆ ਮੈਂ